ਹੈਲੋ ਤੁਸੀਂ ਫਲਿੱਪਕਾਡ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਕੋਲੋਂ ਇੱਕ ਆਡਰ ਬੁੱਕ ਕੀਤਾ ਸੀ ਤੁਹਾਡੀ ਸਾਈਟ ਤੋਂ ਜਿਹਦੇ ਵਿੱਚ ਮੈਂ ਇੱਕ ਕੂਲਰ ਖਰੀਦਿਆ ਸੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਤੁਹਾਡੇ ਨਾਲ ਕੂਲਰ ਮੈਨੂੰ ਸਹੀ ਸਮੇਂ 'ਤੇ ਮਿਲ ਗਿਆ ਅਤੇ ਜਦੋਂ ਮੈਂ ਇਸ ਨੂੰ ਵਰਤਿਆ ਤਾਂ ਮੇਰਾ ਤਜਰਬਾ ਵਧੀਆ ਰਿਹਾ ਕਿਉਂਕਿ ਇਹਦੇ ਨਾਲ ਦਾ ਕੂਲਰ ਮੈਨੂੰ ਮਿਲ ਨਹੀਂ ਸੀ ਰਿਹਾ ਇੱਕ ਤਾਂ ਇਹਦਾ ਜਿਹੜਾ ਰੇਟ ਬਹੁਤ ਘੱਟ ਸੀ ਬਾਜ਼ਾਰ ਨਾਲੋਂ ਅਤੇ ਦੂਸਰਾ ਜਿਹੜਾ ਹੈ ਕਿ ਇਸਦੀ ਬਿਜਲੀ ਦੀ ਖ਼ਪਤ ਬਹੁਤ ਘੱਟ ਹੈ ਅਤੇ ਇਹਦੀ ਕੂਲਿੰਗ ਬਹੁਤ ਵਧੀਆ ਹੈ ਜਲਦੀ ਹੀ ਸਾਰਾ ਹਾਲ ਨੂੰ ਠੰਡਾ ਕਰ ਦਿੰਦਾ ਹੈ ਇਹਦੀ ਪਾਣੀ ਘਰ ਸਟੋਰ ਕਰਨ ਵਾਲਾ ਟੈਂਕ ਵੱਡਾ ਹੈ ਦੋ ਤਿੰਨ ਦਿਨ ਨਿਕਲ ਜਾਂਦੇ ਹਨ ਪਾਣੀ ਭਰਨ ਦੀ ਲੋੜ ਨਹੀਂ ਪੈਂਦੀ ਇਹਦੇ ਥੱਲੇ ਟਾਇਰ ਲੱਗੇ ਹੋਣ ਕਰਕੇ ਅਸੀਂ ਇਸ ਨੂੰ ਕਮਰੇ ਵਿੱਚ ਜਿੱਥੇ ਮਰਜ਼ੀ ਲੈ ਕੇ ਆਸਾਨੀ ਨਾਲ ਜਾ ਸਕਦੇ ਹਾਂ ਅਤੇ ਸਪੀਡ ਵੀ ਵਧਾ ਘਟਾ ਸਕਦੇ ਹਾਂ ਜਿੰਨੀ ਕੁ ਸਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਬਾਕੀ ਮੇਰਾ ਤਜਰਬਾ ਬਹੁਤ ਵਧੀਆ ਰਿਹਾ